ਮੈਂ ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਰਹਿੰਦੀ ਹਾਂ ਪੰਜਾਬ ਵਿੱਚ ਬਹੁਤ ਸਾਰੀ ਸਕੀਮਾਂ ਅਜਿਹੀਆਂ ਹਨ ਜੋ ਕਿ ਲੋੜਵੰਦ ਲੋਕਾਂ ਦੀਆਂ ਸਹਾਇਤਾ ਨੂੰ ਅਤੇ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਖੋਲ੍ਹੀਆਂ ਗਈਆਂ ਹਨ ਜਿਵੇਂ ਕਿ ਬੱਸ ਦਾ ਫ੍ਰੀ ਕਰਾਇਆ ਮੈਂ ਕੋਲੇਜ ਦੀ ਵਿਦਿਆਰਥਣ ਹਾਂ ਅਤੇ ਮੈਂ ਖੁਦ ਸਵੇਰੇ ਸ ਕੋਲੇਜ ਜਾਣ ਸਮੇਂ ਫ੍ਰੀ ਬੱਸ ਦਾ ਹੀ ਇਸਤੇਮਾਲ ਕਰਦੀ ਹਾਂ ਜੋ ਕਿ ਲੋੜਵੰਦ ਇਸਤਰੀਆਂ ਲਈ ਬਹੁਤ ਫਾਇਦੇਮੰਦ ਹੈ ਅਤੇ ਪੰਜਾਬ ਸਰਕਾਰ ਹੋਰ ਵੀ ਯਤਨ ਕਰ ਰਹੀ ਹੈ ਜਿਸ ਨਾਲ ਵਾਸੀਆਂ ਦਾ ਜੀਵਨ ਪੱਧਰ ਉੱਚਾ ਹੋ ਸਕੇ ਅਤੇ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ